ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਕੱਪੜੇ ਸਿਊਣ ਦਾ ਮੇਰੀ ਦਾਦੀ ਜੀ ਨੇ ਮੈਨੂੰ ਕੱਪੜੇ ਸਿਊਣੇ ਸਿਖਾਏ ਸੀ ਅਤੇ ਮੈਂ ਆਪਣੇ ਘਰ ਹੀ ਇੱਕ ਕੰਮ ਖੋਲ੍ਹ ਲਿਆ ਬਟੀਕ ਮੈਂ ਕੱਪੜੇ ਸਿਉਂਦੀ ਹਾਂ ਕਮੀਜ਼ ਬਲਾਊਜ਼ ਸਲਵਾਰ ਸੂਟ ਸਭ ਕੁਝ ਸਿਉਂਦੀ ਹਾਂ ਅਤੇ ਮੈਂ ਸੂਟ ਦਾ ਚਾਰ ਸੌ ਰੁਪਇਆ ਸਲਾਈ ਰੱਖੀ ਸੀ ਅਗਰ ਕੋਈ ਮਗਜੀ ਲਵਾਵੇ ਜਾਂ ਕੋਈ ਹੋਰ ਕੋਈ ਛੋਟਾ ਮੋਟਾ ਕੋਈ ਕੰਮ ਗਲਾ ਕੋਈ ਵਧੀਆ ਬਣਵਾਵੇ ਤਾਂ ਮੈਂ ਉਸਦੇ ਥੋੜ੍ਹੇ ਪੈਸੇ ਜ਼ਿਆਦਾ ਲੈਂਦੀ ਮੇਰੇ ਕੋਲ ਹਰ ਵਰਗ ਦੇ ਲੋਕ ਸਿਲਾਉਣ ਲਈ ਆਉਂਦੇ ਹਨ ਅਮੀਰ ਵੀ ਆਉਂਦੇ ਗਰੀਬ ਵੀ ਆਉਂਦੇ ਮੈਂ ਉਹਨਾਂ ਦੇ ਹਿਸਾਬ ਨਾਲ ਹੀ ਉਹਨਾਂ ਕੋਲੋਂ ਸਲ ਸਿਲਾਈ ਲੈ ਲੈਂਦੀ ਹਾਂ ਔਰ ਮੈਂ ਲੱਡੂ ਗੋਪਾਲ ਦੇ ਕੱਪੜੇ ਵੀ ਸਿਉਂਦੀ ਹਾਂ ਲੱਡੂ ਗੋਪਾਲ ਦੇ ਰਾਤ ਦੇ ਪਾਉਣ ਵਾਲੇ ਸੂਟ ਵੀ ਸਿਉਂਦੀ ਹਾਂ ਅਗਰ ਕੋਈ ਮਗਜ਼ੀਲ ਸਿੱਪੀ ਸਤਾਰੇ ਲਗਵਾਵੇ ਜਾਂ ਕੋਈ ਹੋਰ ਚੀਜ਼ ਲਗਵਾਵੇ ਤਾਂ ਉਸਦੇ ਪੈਸੇ ਅਲੱਗ ਲੱਗਦੇ ਹਨ ਅਗਰ ਕੋਈ ਸਿੰਪਲ ਸਿਲਵਾਵੇ ਤਾਂ ਉਸਦੇ ਪੈਸੇ ਮੈਂ ਘੱਟ ਲੈਂਦੀ ਹਾਂ ਇਸ ਕਰਕੇ ਮੈਨੂੰ ਹਰ ਚੀਜ਼ ਦਾ ਸ਼ੌਂਕ ਹੈ ਮੈਂ ਮੈਂ ਬਹੁਤ ਸਾਰੇ ਸੂਟ ਸਿਲ ਦਿੱਤੇ ਹਨ ਅਤੇ ਕਿਸੇ ਦਾ ਕੋਈ ਉਲਾਂਭਾ ਨਹੀਂ ਆਇਆ ਸਭ ਨੂੰ ਪਸੰਦ ਆਏ ਹਨ